ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਅਮਨ ਬੁਟੀਕ ਤੋਂ ਬੋਲਦੇ ਹੋ ਹਾਂਜੀ ਮੈਮ ਅਸੀਂ ਨਾ ਕੱਪੜੇ ਸਲਾਈ ਕਰਾਉਣੇ ਸੀਗੇ ਅਤੇ ਤੁਸੀਂ ਕੱਪੜੇ ਕੱਪੜੇ ਸੀ ਦੋਗੇ ਸਾਡੇ ਅਤੇ ਸਾਡੇ ਨਾ ਮੈਰਜ ਹੈਗੀ ਦਸ ਮਾਰਚ ਦੀ ਹਾਂਜੀ ਅਤੇ ਸਾਨੂੰ ਦਸ ਮਾਰਚ ਤੋਂ ਵੀ ਪਹਿਲਾਂ ਚਾਹੀਦੇ ਨੇ ਸੂਟ

ਸਾਡੇ ਛੇ ਸੱਤ ਸੂਟ ਹੈਗੇ ਨੇ ਜੀ ਮਿਕਸ ਮਿਕਸ ਹੀ ਕਰਨੇ ਆ ਸਲਵਾਰ ਸੂਟ ਵੀ ਬਣਾਉਣੇ ਆ ਪਲਾਜੋ ਵੀ ਬਣਾਉਣਾ ਜੀ ਅਤੇ ਹਾਂਜੀ ਜਿਹੜੇ ਜਿਹੜੇ ਸੂਟ ਆ ਸਾਡੇ ਹਾਂਜੀ ਸਾ ਸਾਨੂੰ ਦਸ ਮਾਰਚ ਤੋਂ ਦੇਖ ਲਓ ਹੈ ਨਾ ਤਿੰਨ ਚਾਰ ਦਿਨ ਪਹਿਲਾਂ ਤਾਂ ਚਾਹੀਦੇ ਨੇ ਸੂਟ ਹੈ ਨਾ ਹਾਂਜੀ ਮੈਂ ਪਹਿਲਾਂ ਸੀ ਨਾ ਕਿਸੇ ਤੋਂ ਸਿਲਾਈ ਕਰਾਏ ਸੀ ਉਹ ਸਾਡੇ ਨਾ ਬੱਚਿਆਂ ਨੇ ਪਸੰਦ ਨਹੀਂ ਕੀਤੇ ਸੂਟ ਤਾਂ ਸਾਨੂੰ ਵੀ ਕਿਸੇ ਕਿਸਮ ਦਾ ਸੂਟ ਤੋਂ ਕੋਈ ਲਾਂਭਾ ਨਹੀਂ ਆਉਣਾ ਚਾਹੀਦਾ ਠੀਕ ਹੈ

ਤੁਸੀਂ ਵ ਤੁਸੀਂ ਹਾਂਜੀ ਮੈਮ ਤੁਸੀਂ ਵਰਕ ਵਗੈਰਾ ਵੀ ਕਰ ਦਿੰਦੇ ਹੋ

ਅਤੇ ਜਿਹੜੀ ਲੋਨ ਵਗੈਰਾ ਤੁਸੀਂ ਆਪਣੇ ਆਪ ਲੈ ਲਓਗੇ ਲੋਨ ਵਗੈਰਾ ਹਾਂਜੀ ਪਤਾ ਲੋਨ ਲੋਨ ਬਿਲਕੁਲ ਗਰੰਟੀ ਵਾਲੀ ਹੋਣੀ ਚਾਹੀਦੀ ਹੈ ਹੈ ਨਾ ਵੀ ਪਹਿਲਾਂ ਵੀ ਸਾਡੇ ਜਿਹੜੇ ਸੂਟ ਬਣਾਏ ਸੀ ਜਿਹੜੀ ਲੋਨ ਸੀ ਨਾ ਉਹ ਇਕੱਠੀ ਹੋ ਜਾਂਦੀ ਸੀਗੀ ਕਮੀਜ਼ ਦੀ ਹਾਂਜੀ ਅਤੇ ਸਾਨੂੰ ਵੀ ਸੂਟ ਸਾਨੂੰ ਟਾਈਮ 'ਤੇ ਚਾਹੀਦੇ ਨੇ ਅਤੇ ਕੋਈ ਵੀ ਨਾ ਕੋਈ ਲਾਂਬੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਲੋਨ ਵਗੈਰਾ ਉਹ ਸਹੀ ਹੋਣੀ ਚਾਹੀਦੀ ਹੈ ਅਤੇ ਫੇਰ ਆਪਣਾ ਵੀ ਇੱਕ ਸੂਟ ਦੀ ਸਿਲਾਈ ਵਗੈਰਾ ਵੀ ਪ੍ਰਾਈਸ ਨਾ ਸੂਟ ਦਾ ਸਿਲਾਈ ਤੁਸੀਂ ਹਾਂ ਹਾਂਜੀ ਮੈਮ ਅਤੇ ਹੁਣ ਤੁਹਾਨੂੰ ਹਾਂਜੀ ਅੱਛਾ ਜੀ ਅਤੇ ਮੈਮ ਹੁਣ ਤੁਹਾਨੂੰ ਜੇ ਮਿਲਣਾ ਹੋਵੇ ਅਸੀਂ ਫਿਰ ਤੁਹਾਡਾ ਟਾਈਮ ਕੀ ਹੈ ਮਿਲਣ ਦਾ ਅੱਛਾ ਜੀ ਅੱਛਾ ਜੀ ਅੱਛਾ ਜੀ ਅਤੇ ਆਪਣੇ ਸਿਲਾਈ ਤੁਹਾਡੇ ਵੀ ਜੈਂਟਸ ਕਰਦੇ ਕਿ ਆਪਣੇ ਕੁੜੀਆਂ ਰੱਖੀਆਂ ਹੋਈਆਂ ਸਿਲਾਈ ਕਰਨ ਨੂੰ ਅੱਛਾ ਜੀ ਸੂਟ ਸਾਨੂੰ ਟਾਈਮ 'ਤੇ ਮਿਲਣੇ ਚਾਹੀਦੇ ਨੇ ਹੈ ਨਾ ਕੋਈ ਲਾਂਭੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਹਾਂਜੀ ਪਹਿਲਾਂ ਅਸੀਂ ਸਿਲਾਈ ਕਰਾਏ ਸੀ ਸੂਟ ਸਾਡੇ ਉਹ ਬਿਲਕੁਲ ਪਸੰਦ ਨਹੀਂ ਆਏ ਇਹਦੇ ਅਤੇ ਸਾਨੂੰ ਨਾ ਕਿਸੇ ਨੇ ਦੱਸਿਆ ਸੀਗਾ ਤੁਹਾਡੇ ਬਾਰੇ ਵੀ ਅਮਨ ਬਟੀਕ ਨੇ ਅਤੇ ਹਾਂਜੀ ਹਾਂਜੀ ਇਹ ਮੈਮ ਬੁਟੀਕ ਤੁਹਾਡੀ ਕਿੱਥੇ ਕ ਪੈ ਜਾਂਦੀ ਹੈ ਜੀ ਅਤੇ ਹਾਂਜੀ ਕੋਈ ਗੱਲ ਨਹੀਂ ਫਿਰ ਮੈਮ ਅਸੀਂ ਅੱਛਾ ਜੀ ਕੋਈ ਨਹੀਂ ਫਿਰ ਆਪਾਂ ਮਿਲ ਕੇ ਨਾ ਸੂਟ ਦੇ ਕੇ ਜਾਵਾਂਗੇ ਅਤੇ ਸਾਡੇ ਸੂਟ ਦੀ ਬਸ ਕੋਈ ਲਾਂਭਾ ਨਾ ਸਾਨੂੰ ਆਵੇ ਗਾਹਾਂ ਨੂੰ ਫਿਰ ਤੁਹਾਨੂੰ ਹੋਰ ਵੀ ਦੇਵਾਂਗੇ ਠੀਕ ਹੈ ਆਪਣੇ ਹਾਂਜੀ ਅੱਛਾ ਜੀ ਅਤੇ ਹਾਂਜੀ ਠੀਕ ਹੈ ਓਕੇ ਓਕੇ